ਹਾਂਜੀ ਮੈਨੂੰ ਬਹੁਤ ਮੌਕੇ ਆਏ ਜਦੋਂ ਜਦੋਂ ਕਿ ਚੁਣੌਤੀਪੂਰਨ ਸਨ ਵੈਸੇ ਮੈਨੂੰ ਪੜ੍ਹਾਈ ਦਾ ਹੀ ਸ਼ੌਂਕ ਸੀ ਪਰ ਵਿੱਚ ਵਿੱਚ ਜਦੋਂ ਛੁੱਟੀਆਂ ਪੈਂਦੀਆਂ ਪੇਪਰਾਂ ਤੋਂ ਬਾਅਦ ਮੇਰੇ ਮਾਤਾ ਜੀ ਮੈਨੂੰ ਸਿਲਾਈ ਅਤੇ ਬੁਣਾਈ ਸਿਖਾਉਂਦੇ ਰਹਿੰਦੇ ਸਨ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੇਰੇ ਸਹੁਰੇ ਮੇਰੀ ਪੜ੍ਹਾਈ ਤੋਂ ਜ਼ਿਆਦਾ ਸਿਲਾਈ ਬੁਣਾਈ ਤੋਂ ਖੁਸ਼ ਸੀ ਜੋ ਮੇਰੇ ਲਈ ਚੁਣੌਤੀਪੂਰਨ ਸੀ ਕਿਉਂਕਿ ਸਿਲਾਈ ਅਤੇ ਬੁਣਾਈ 'ਤੇ ਹੀ ਜਿਆਦਾ ਕੰਮ ਕਰਨਾ ਸੀ ਸਭ ਤੋਂ ਪਹਿਲਾਂ ਮੈਂ ਆਪਣੇ ਪਤੀ ਲਈ ਇੱਕ ਕੁੜਤਾ ਪਜਾਮਾ ਬਣਾਇਆ ਅੰਦਾਜੇ ਨਾਲ ਮੈਂ ਕੁੜਤਾ ਕੱਟਿਆ ਅਤੇ ਬਣਾਇਆ ਅਤੇ ਪਜਾਮਾ ਵੀ ਕੱਟਣ ਦੀ ਕੋਸ਼ਿਸ਼ ਕੀਤੀ ਅਤੇ ਬਣਾਇਆ ਗੁਜ਼ਾਰੇ ਲਾਈਕ ਠੀਕ ਠਾਕ ਬਣ ਗਿਆ ਫਿਰ ਮੈਂ ਆਪਣੇ ਪਤੀ ਲਈ ਇੱਕ ਸਵੈਟਰ ਵੀ ਬੁਣਿਆ ਜੋ ਕਿ ਉਹ ਪੁਰਾਣੇ ਸਵੈਟਰ ਨੂੰ ਉਦੇੜ ਕੇ ਅੱਟੀਆਂ ਬਣਾ ਕੇ ਗੋਲੇ ਬਣਾ ਕੇ ਫਿਰ ਬੁਣਨਾ ਸੀ ਫਿਰ ਮੈਂ ਪੁੱਛ ਪੁੱਛ ਕੇ ਘੂਰੇ ਪਾਏ ਫਿਰ ਮੋਢਿਆਂ 'ਤੇ ਆ ਕੇ ਕਿੰਨੇ ਘੂਰੇ ਘਟਾਣੇ ਸੀ ਪੁੱਛਿਆ ਫਿਰ ਗਲੇ 'ਤੇ ਵੀ ਘੂਰੇ ਘਟਾਉਣੇ ਪੈਂਦੇ ਹਨ ਫਿਰ ਘੂਰੇ ਦੁਬਾਰਾ ਚੁੱਕਣੇ ਗਲੇ ਦਾ ਬਾਰਡਰ ਬਣਾਉਣਾ ਸੀ ਫਿਰ ਦੋਵੇਂ ਬਾਹਾਂ ਦੇ ਬੋਰਡਰ ਵਿੱਚ ਹਰ ਸਲਾਈ ਉੱਤੇ ਬਾਰੇ ਘੂਰੇ ਵਧਾਉਣੇ ਫਿਰ ਸਾਰੀ ਬਾਂਹ ਬਣਾ ਕੇ ਥੋੜ੍ਹੇ ਥੋੜ੍ਹੇ ਕਰਕੇ ਘੂਰੇ ਘਟਾਉਣੇ ਪੈਂਦੇ ਸੀ ਫਿਰ ਕੰਦੂਈ ਨਾਲ ਉਹਨਾਂ ਦਾ ਧਾਗਾ ਪਾ ਕੇ ਬਾਹਾਂ ਨੂੰ ਆਪਸ ਵਿੱਚ ਜੋੜਨਾ ਫਿਰ ਮੋਢੇ ਤੋਂ ਸਵੈਟਰ ਨਾਲ ਜੋੜਨਾ ਸੀ ਫਿਰ ਅੱਗੇ ਪਿੱਛੇ ਪੱਲੇ ਨੂੰ ਵੀ ਆਪਸ ਵਿੱਚ ਜੋੜਨਾ ਸੀ ਮੇਰੇ ਲਈ ਬਹੁਤ ਹੀ ਵੱਡੀ ਚੁਣੌਤੀ ਸੀ ਫਿਰ ਮੈਂ ਦਸਤਾਨੇ ਅਤੇ ਆਪਣੇ ਬੇਬੀ ਲਈ ਸਵੈਟਰ ਬਣਾਇਆ ਜੋ ਗਲੇ ਤੋਂ ਸ਼ੁਰੂ ਹੋ ਕੇ ਖ ਖਤਮ ਬਾਡਰ 'ਤੇ ਹੁੰਦਾ ਸੀ ਅਤੇ ਬਾਹਾਂ ਵਿੱਚੋਂ ਹੀ ਕੱਢਣੀਆਂ ਸਨ ਬਣਾਉਣ ਤੋਂ ਬਾਅਦ ਮੈਨੂੰ ਬਹੁਤ ਖੁਸ਼ੀ ਹੋਈ ਮੇਰਾ ਸਹੁਰਾ ਪਰਿਵਾਰ ਅਤੇ ਮੇਰਾ ਪਤੀ ਵੀ ਬਹੁਤ ਖੁਸ਼ ਹੋਏ ਉਹ ਆਪਣੇ ਹੱਥ ਦੀਆਂ ਚੀਜ਼ਾਂ ਬਣਾਈਆਂ ਮੈਂ ਅੱਜ ਤੱਕ ਸਾਂਭ ਕੇ ਰੱਖੀਆਂ ਹਨ